ਜੇ ਗੱਲ ਮੇਰੀ ਮੰਨੀ ਜਾਏ ਤਾਂ ਹਾਂ ਇਹ ਬਹੁਤ ਹੀ ਖਤਰਨਾਕ ਚੀਜ਼ ਹੈ ਮੈਂ ਖੁਦ ਦੀ ਇਗਜਾਮਪਲ ਦੇਵਾਂ ਮੈਂ ਖੁਦ ਆਪਣੇ ਅੱਜ ਤੋਂ ਤਿੰਨ ਸਾਲ ਪਹਿਲਾਂ ਸ਼ੇਅਰ ਮਾਰਕੀਟ ਵਿੱਚ ਉਹਨੂੰ ਬੇਸਿਸ ਨੂੰ ਬਿਨਾਂ ਸਮਝੇ ਉਸ 'ਤੇ ਇਨਵੈਸਟ ਤਾਂ ਕਰ ਦਿੱਤਾ ਸੀਗਾ ਜਿਸ ਦੀ ਅਮਾਊਂਟ ਸੀਗਾ ਇੱਕ ਲੱਖ ਰੁਪਿਆ ਲੱਖ ਰੁਪਿਆ ਇਨਵੈਸਟ ਕਰਨ ਤੋਂ ਬਾਅਦ ਮੈਂ ਪਹਿਲਾਂ ਤਾਂ ਬਹੁਤ ਖੁਸ਼ ਸੀਗਾ ਜਦੋਂ ਉਹ ਉੱਪਰ ਜਾ ਰਹੇ ਸਨ ਜਦੋਂ ਮੇਰੇ ਪੈਸੇ ਵੱਧ ਰਹੇ ਸਨ ਪਰ ਜਦੋਂ ਇਕਦਮ ਹੀ ਗਿਰਾਵਟ ਆਉਂਦੇ ਉਨ੍ਹਾਂ ਦਾ ਪੰਜਾਹ ਹਜ਼ਾਰ ਰਹਿ ਗਿਆ ਤਾਂ ਮੈਂ ਬਹੁਤ ਹੀ ਸ਼ੋਕ ਵਿੱਚ ਚਲਾ ਗਿਆ ਉਹ ਪੰਜਾਹ ਹਜ਼ਾਰ ਦੀ ਅੱਜ ਵੇਟ ਕਰਦੇ ਕਰਦੇ ਮੈਂ ਸੋਚ ਰਿਹਾ ਸੀਗਾ ਕਿ ਸ਼ਾਇਦ ਅੱਜ ਜਾਂ ਕੱਲ੍ਹ ਵਿੱਚ ਜਾਂ ਥੋੜ੍ਹੇ ਟਾਈਮ ਵਿੱਚ ਅਗੇਨ ਉਹ ਵੱਧ ਜਾਵੇਗਾ ਪਰ ਉਹ ਵੱਧਣ ਦੀ ਬਜਾਏ ਹੋਰ ਬਾਏ ਹੋਰ ਘੱਟਦਾ ਹੀ ਗਿਆ ਜੋ ਕਿ ਅੱਜ ਬਹੁਤ ਹੀ ਘੱਟ ਚੁੱਕਾ ਹੈ ਨਾ ਦੇ ਬਰਾਬਰ ਹੀ ਹੋ ਚੁੱਕਾ ਹੈ ਮੈਂ ਸਭ ਨੂੰ ਇੱਕੋ ਹੀ ਚੀਜ਼ ਦੱਸਣਾ ਚਾਹਾਂਗਾ ਅਗਰ ਤਾਂ ਤੁਸੀਂ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਂਦੇ ਹੋ ਤਾਂ ਉਸ ਨੂੰ ਪਹਿਲਾਂ ਪੂਰਾ ਹੀ ਸਮਝਿਆ ਜਾਵੇ ਤਾਂ ਫਿਰ ਹੀ ਉਸ ਵਿੱਚ ਇਨਵੈਸਟ ਕੀਤਾ ਜਾਏ ਅਤੇ ਜੋ ਵੀ ਤੁਸੀਂ ਸ਼ੇਅਰ ਖਰੀਦ ਦੇ ਹੋ ਉਹ ਸ਼ਰੀਰ ਪਹਿਲੇ ਸ਼ੇ ਉਸ ਸ਼ੇਅਰ ਬਾਰੇ ਪਹਿਲਾਂ ਪੂਰੀ ਨੌਲੇਜ ਲਿੱਤੀ ਜਾਵੇ ਕਿ ਉਸ ਦੇ ਉਤਾਰ ਚੜਾਵ ਕਿਸ ਤਰੀਕੇ ਦੇ ਹਨ ਅਤੇ ਕਿੰਨੇ ਟਾਈਮ ਬਾਅਦ ਵਧਦੇ ਹਨ ਅਤੇ ਕਿੰਨੇ ਟਾਈਮ ਘੱਟਦੇ ਹਨ ਅਤੇ ਉਸ ਦੀ ਪਹਿਲੀ ਹਿਸਟਰੀ ਕੀ ਹੈ ਤਾਂ ਹੀ ਤੁਸੀਂ ਉਸ 'ਤੇ ਇਨਵੈਸਟ ਕਰੋ ਬੇ ਫਿਜ਼ਾ ਬੇਫਜੂਲ ਬਿਨਾਂ ਸੋਚੇ ਸਮਝੇ ਬਿਨਾਂ ਸ਼ੇਅਰ ਨੂੰ ਸਮਝੇ ਉਸ ਉੱਤੇ ਇਨਵੈਸਟ ਕਰਨਾ ਬਹੁਤ ਹੀ ਵੱਡੀ ਬੇਵਕੂਫੀ ਹੈ